ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂ ਅੱਛਾ ਜੀ ਠੀਕ ਹੈ ਜੀ ਹਾਂਜੀ ਕਪੂਰਥਲੇ 'ਚ ਤਾਂ ਬਹੁਤ ਭਾਅ ਜੀ ਹੈਗੇ ਸ਼ਾਲੀਮਾਰ ਬਾਗ ਹੈਗਾ ਆਪਣਾ ਕਮਰਾ ਬਾਗ ਕੈਮਰਾ ਕਮਰਾ ਗਾਰਡਨ ਹੈਗਾ ਆਪਣਾ ਸੈਨਿਕ ਸਕੂਲ ਦੇ ਅੰਦਰ ਬਹੁਤ ਹੀ ਗਾਰਡਨ ਹੈਗੇ ਹੈ ਭਾਅ ਜੀ ਉੱਥੇ ਤਾਂ ਚੀਜਾਂ ਹੀ ਬਹੁਤ ਦੇਖਣ ਨੂੰ ਮਿਲਣੀਆਂ ਤੁਹਾਨੂੰ ਸ਼ਾਲੀਮਾਰ ਬਾਗ ਦੇ ਵਿੱਚ ਜਿਵੇਂ ਆਪਣਾ ਕਹਿ ਸਕਦੇ ਹਾਂ ਕਿ ਰਾਣੇ ਦਾ ਬਾਗ ਦੇ ਵਿੱਚ ਨਾ ਰਾਜੇ ਦਾ ਮਹਿਲ ਹੈਗਾ ਉਹਦੇ ਵਿੱਚ ਹੀ ਕਾਫ਼ੀ ਕੁਝ ਦੇਖਣ ਨੂੰ ਮਿਲਦਾ ਕਾਫ਼ੀ ਉੱਥੇ ਨਾ ਆ ਜਿਹੜੀ ਫੋਟੋਆਂ ਬਣਾਈਆਂ ਹੋਈਆਂ ਜਿਹੜੀਆਂ ਆਪਾਂ ਕਹਿ ਦੇ ਚਿੱਤਰਕਾਰੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਹਾਂਜੀ ਜਗਜੀਤ ਸਿੰਘ ਹਾਂਜੀ ਅਤੇ ਜਗਜੀਤ ਸਿੰਘ ਰਾਜਾ ਜੀ ਆਪਣੇ ਹੈਗੇ ਅਤੇ ਉਹਨਾਂ ਦੀ ਨਾ ਅੰਦਰ ਕਾਫ਼ੀ ਬਣੀ ਹੋਈਆਂ ਚੀਜ਼ਾਂ ਉਹ 'ਚ ਕਾਫ਼ੀ ਕਹਿ ਸਕਦੇ ਚਿੱਤਰਕਾਰੀ ਕਹਿ ਸਕਦੇ ਜਿੱਦਾਂ ਆਪਾਂ ਉਹ ਫੋਟੋਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਬਾਕੀ ਜਿਹੜਾ ਇੱਥੇ ਘੁੰਮਣ ਆਉਂਦਾ ਨਾ ਇੱਕ ਇੱਥੇ ਫਲਾਵਰ ਜਿਹੜੀ ਹੈਗੀ ਆ ਉਹਦੀ ਸੈਟਿੰਗ ਬਹੁਤ ਇੰਨੀ ਵਧੀਆ ਆ ਕਿ ਲੋਕ ਦੇਖਦੇ ਹੀ ਰਹਿ ਜਾਂਦੇ ਅਤੇ ਆਪਾਂ ਜੇ ਨਹੀਂ ਸਰ ਮਹਿਲ 'ਚ ਤਾਂ ਨਹੀਂ ਕੋਈ ਰਹਿੰਦਾ ਉਹਨਾਂ ਦੇ ਓ ਜਿੱਦਾਂ ਆਪਾਂ ਕਹਿ ਸਕਦੇ ਕਿਰਪਾਨ ਪਈ ਆ ਭਾਲਾ ਪਿਆ ਵਾ ਇਹ ਬੰਦੂਕਾਂ ਵਗੈਰਾ ਬਹੁਤ ਪਈਆਂ ਉੱਥੇ ਉਹ ਚੀਜ਼ਾਂ ਕਾਫ਼ੀ ਦੇਖਣ ਨੂੰ ਹੈਗੀਆ ਜਿੱਦਾ ਹਾਂ ਹਾਂਜੀ ਹਾਂਜੀ ਉਹ ਬਣਾਇਆ ਹੋਇਆ ਇਹ ਕਾਫ਼ੀ ਕੁਝ ਦੇਖਣ ਨੂੰ ਏ ਉਹ ਮਤਲਵ ਉਨਾਂ ਦਾ ਕਾਫ਼ੀ ਸਮਾਨ ਜਿੱਦਾਂ ਸੈਨਿਕ ਸਕੂਲ ਸਾਡੇ ਉੱਥੇ ਹੋਵੇਗਾ ਉਹਦੇ ਅੰਦਰ ਜਿਹੜਾ ਗਾਰਡਨ ਬਣਾਇਆ ਉੱਥੇ ਵੀ ਪਰ ਰੱਖਿਆ ਹੋਇਆ ਉਹਨਾਂ ਨੇ ਸਮਾਨ ਜਿੱਦਾਂ ਜਿੱਦਾਂ ਉਹਨਾਂ ਨੇ ਯੂਜ ਕਰਦੇ ਸੀਗੇ ਰੱਥ ਵਗੈਰਾ ਯੂਜ ਕਰਦੇ ਸੀ ਜਿਹੜੇ ਉਹ ਸੋਨੇ ਦੇ ਜਿੱਦਾਂ ਹੀਰ ਮੁਕਟ ਵਗੈਰਾ ਸਾਰਾ ਕੁਝ ਉੱਥੇ ਪਿਆ ਹੈ ਭਾਅ ਜੀ ਅਤੇ ਕਾਫ਼ੀ ਕੁਛ ਹੈਗਾ ਦੇਖਣ ਨੂੰ ਮਿਲਦਾ ਇੱਥੇ ਭਾਅ ਜੀ ਤੁਸੀਂ ਇੱਕ ਵਾਰੀ ਮੌਕਾ ਦਿਓ ਸਾਨੂੰ ਕਿਹੜਾ ਜੀ ਹਾਂ ਸੈਨਿਕ ਸਕੂਲ ਦੇ ਜਿਹੜੇ ਗਾਰਡਨ ਨੀ ਹੈਗਾ ਅੰਦਰ ਉਹਦੇ ਵਿੱਚ ਤੇ ਇੱਕ ਤਾਂ ਰਾਜੇ ਦੀ ਨਾ ਸਾਰਾ ਉਹ ਕਿਉਂਕਿ ਸੈਨਿਕ ਸਕੂਲ ਸਿਰਫ਼ ਉਹਨਾਂ ਬਣਾਇਆ ਵਾ ਉਹ ਹੈ ਰਾਜੇ ਦੀ ਜਗ੍ਹਾ ਹੀ ਹੈ ਉਹਨਾਂ ਦੇ ਵਿੱਚ ਬਾਗ ਦੇ ਵਿੱਚ ਨਾ ਕਾਫ਼ੀ ਫਲਾਵਰ ਆ ਜਿਹੜੇ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਦੇਖਣ ਨੂੰ ਮਿਲਦੇ ਉੱਥੇ ਤੁਹਾਨੂੰ ਦੇਖਣ ਨੂੰ ਮਿਲਣੇ ਇਹ ਸਾਰੇ ਉਹ ਫੁੱਲ ਜਿੱਦਾਂ ਸਵੇਰ ਨੂੰ ਫੁੱਲ ਦਾ ਰੰਗ ਹੋਰ ਦੁਪਹਿਰ ਨੂੰ ਹੋਰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਉੱਥੇ ਉੱਥੇ ਤਾਂ ਕਾਫ਼ੀ ਰੱਸ਼ ਹੁੰਦਾ ਭਾਅ ਜੀ ਉਸ ਤੋਂ ਬਾਅਦ ਫੀਸ ਤਾਂ ਜਿੰਨੀ ਮਰਜ਼ੀ ਦੇ ਦਿਓ ਇੱਕ ਵਾਰੀ ਮੌਕਾ ਦਿਓ ਤੁਸੀਂ ਬਸ ਹੂੰ ਹਾਂਜੀ ਹਾਂਜੀ ਸਭ ਕੁਝ ਸਾਡਾ ਜੀ ਠੀਕ ਹੈ ਸਰ ਠੀਕ ਓ ਠੀਕ ਹੈ ਸਰ